ਮੇਰਾ ਨਾਂ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਮੈਨੂੰ ਬਾਈਕਾਂ 'ਤੇ ਘੁੰਮਣਾ ਬਹੁਤ ਪਸੰਦ ਹੈ ਕਿਉਂਕਿ ਬਾਈਕਾਂ 'ਤੇ ਘੁੰਮਣ ਨਾਲ਼ ਸਾਨੂੰ ਵੱਖਰੀ ਵੱਖਰੀ ਜਗ੍ਹਾ ਦਾ ਅਨੁਮਾਨ ਹੋ ਜਾਂਦਾ ਹੈ ਅਤੇ ਬਹੁਤ ਮਜ਼ਾ ਆਉਂਦਾ ਹੈ ਅਤੇ ਮੈਨੂੰ ਜ਼ਿਆਦਾਤਰ ਜ਼ ਮੈਨੂੰ ਜ਼ਿਆਦਾਤਰ ਸਹੀ ਮੌਸਮ ਮਤਲਬ ਕਿ ਠੰਡੇ ਮੌਸਮ ਦੇ ਵਿੱਚ ਹੀ ਘੁੰਮਣ ਦਾ ਮਜ਼ਾ ਆਉਂਦਾ ਹੈ ਕਿਉਂਕਿ ਜੇਕਰ ਜ਼ਿਆਦਾ ਧੁੱਪ ਹੋਵੇ ਤਾਂ ਘੁੰ ਗਰਮੀ ਨਾਲ਼ ਬੁਰਾ ਹਾਲ ਹੋ ਜਾਂਦਾ ਹੈ ਅਤੇ ਜੇਕਰ ਵਰਖਾ ਪੈ ਰਹੀ ਹੋਏ ਤਾਂ ਕੱਪੜੇ ਭਿੱਜ ਜਾਂਦੇ ਹਨ ਅਤੇ ਗਰਮ ਸਰਦ ਹੋਣ ਦਾ ਚਾਂਸ ਰਹਿੰਦਾ ਹੈ ਇਸ ਕਰਕੇ ਮੌਸਮ ਥੋੜ੍ਹਾ ਥੋੜ੍ਹਾ ਠੰਡਾ ਅਤੇ ਹਵਾ ਚੱਲਦੀ ਹੋਵੇ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਰਦੀਆਂ ਵਿੱਚ ਘੁੰਮਣ ਦਾ ਬਹੁਤ ਮਜ਼ਾ ਆਉਂਦਾ ਹੈ ਗਰਮੀਆਂ ਵਿੱਚ ਮੱਤ ਵੱਜ ਜਾਂਦੀ ਹੈ ਜੇਕਰ ਮੈਂ ਗੱਲ ਕਰਾਂ ਤਾਂ ਘੁੰਮਣਾ ਬਹੁਤ ਵਧੀਆ ਹੈ ਅਤੇ ਮੌਸਮ ਸਾਫ਼ ਹੋਣਾ ਚਾਹੀਦਾ ਹੈ ਸਾਫ਼ ਮੌਸਮ ਵਿੱਚ ਹੀ ਘੁੰਮਣ ਦਾ ਮਜ਼ਾ ਆਉਂਦਾ ਹੈ ਜੇਕਰ ਮੌਸਮ ਖ਼ਰਾਬ ਹੋਵੇ ਤਾਂ ਘੁੰਮਣ ਦਾ ਕੋਈ ਮਜ਼ਾ ਨਹੀਂ ਆਉਂਦਾ ਅਤੇ ਸਾਰਾ ਟ੍ਰਿਪ ਖ਼ਰਾਬ ਹੋ ਜਾਂਦਾ ਹੈ ਬਾਈਕ 'ਤੇ ਘੁੰਮਣ ਲਈ ਸਹੀ ਮੌਸਮ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਹੀ ਮੌਸਮ ਨਾਲ਼ ਹੀ ਘੁੰਮਣ ਦਾ ਮਜ਼ਾ ਆਉਂਦਾ ਹੈ ਮੌਸਮ ਸਾਫ਼ ਹੋਵੇ ਤਾਂ ਕਈ ਵਾਤਾਵਰਨ ਲਾਗੇ ਛਾਗੇ ਦੇ ਪਹਾੜ ਫਿਰ ਨਦੀਆਂ ਸਭ ਕੁਝ ਸਾਫ਼ ਨਜ਼ਰ ਆਉਂਦਾ ਹੈ ਜੇ ਵਰਖਾ ਪੈ ਰਹੀ ਹੋਵੇ ਤਾਂ ਕੁਛ ਨਹੀਂ ਪਤਾ ਲੱਗਦਾ ਮੈਂ ਆਪ ਜੀ ਨੂੰ ਇਹੀ ਕਹਵਾਂਗਾ ਕਿ ਜਦੋਂ ਵੀ ਤੁਸੀਂ ਘੁੰਮਣ ਜਾਓ ਤਾਂ ਮੌਸਮ ਸਾਫ਼ ਹੋਣਾ ਚਾਹੀਦਾ ਹੈ ਅਤੇ ਠੰਡਾ ਹੋਣਾ ਚਾਹੀਦਾ ਹੈ ਜਿਸ ਨਾਲ਼ ਸਾਨੂੰ ਗਰਮੀ ਨਾ ਲੱਗੇ ਮੌਸਮ ਸਾਫ਼ ਹੋਣ ਨਾਲ਼ ਹੀ ਘੁੰਮਣ ਦਾ ਮਜ਼ਾ ਆਉਂਦਾ ਹੈ